ਸਕੂਲ ਦੇ ਵਿੱਚ ਸਾਇੰਸ ਦਾ ਵਿਸ਼ਾ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਕਿਉਂਕਿ ਸਾਇੰਸ ਦਾ ਵਿਸ਼ਾ ਇੱਕ ਸਾਡਾ ਅਜਿਹਾ ਵਿਸ਼ਾ ਸੀ ਜਿਹਦੇ ਨਾਲ਼ ਸਾਨੂੰ ਪ੍ਰੈਕਟੀਕਲੀ ਸਰ ਬਹੁਤ ਅੱਛਾ ਸਮਝਾਉਂਦੇ ਸੀ ਅਸੀਂ ਉਸ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਸੀਗੇ ਇਸ ਤੋਂ ਸਿਵਾ ਅਗਰ ਮੈਂ ਕਹਾਂ ਤਾਂ ਸਾਰੇ ਹੀ ਵਿਸ਼ੇ ਮੈਨੂੰ ਅੱਛੇ ਲੱਗਦੇ ਸੀਗੇ ਪਰ ਡਰਾਇੰਗ ਜਿਹੜਾ ਕਿ ਆਰਟ ਐਂਡ ਕਰਾਫਟ ਦਾ ਵਿਸ਼ਾ ਸੀਗਾ ਉਹ ਮੈਨੂੰ ਕਾਫ਼ੀ ਜ਼ਿਆਦਾ ਔਖਾ ਲੱਗਦਾ ਸੀ ਉਸਦਾ ਇੱਕ ਕਾਰਨ ਇਹ ਵੀ ਸੀ ਕਿ ਉਹਨਾਂ ਦੀਆਂ ਜਿਹੜੀਆਂ ਮਈਯਰਮੈਂਟਸ ਲੈਣੀਆਂ ਨੇ ਉਹ ਮੈਨੂੰ ਥੋੜ੍ਹੀਆਂ ਜਿਹੀਆਂ ਔਖੀਆਂ ਲੱਗਦੀਆਂ ਸਨ ਸਕੂਲ ਦੇ ਵਿੱਚ ਜਦੋਂ ਅਸੀਂ ਐਕਸਪੈਰੀਮੈਂਟ ਦੇ ਲਈ ਸਰ ਸਾਨੂੰ ਲੈ ਕੇ ਜਾਂਦੇ ਤਾਂ ਲੈਬੋਰਟਰੀ ਦੇ ਵਿੱਚ ਜਦੋਂ ਅਸੀਂ ਦੇਖਦੇ ਕਿ ਸਰ ਐਕਸਪੈਰੀਮੈਂਟ ਕਰ ਰਹੇ ਨੇ ਤਾਂ ਅਸੀਂ ਬਹੁਤ ਜ਼ਿਆਦਾ ਇੰਜੋਏ ਕਰਦੇ ਅਤੇ ਸਾਨੂੰ ਇਹ ਸਾਰਾ ਇੱਕ ਕਿਸੇ ਮੈਜਿਕ ਦੀ ਤਰ੍ਹਾਂ ਲੱਗਦਾ ਸੀ